ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਜੀ ਹਾਂਜੀ ਹਾਂਜੀ ਹਾਂਜੀ

ਤੁਹਾਨੂੰ ਸਿੰਗਲ ਸਟੋਰੀ ਚਾਹੀਦੀ ਹੈ ਜਾਂ ਡਬਲ ਚਾਹੀਦੀ ਹੈ ਜੀ ਠੀਕ ਹੈ ਠੀਕ ਹੈ ਜੀ ਕੋਈ ਨਹੀਂ ਕੋਠੀਆਂ ਪਈਆਂ ਹੈਗੀਆਂ ਤਿੰਨ ਚਾਰ ਕੋਠੀਆਂ ਹੈਗੀਆਂ ਸਿੰਗਲ ਸਟੋਰੀ 'ਚ ਹਾਂਜੀ ਜੀ ਜੇ ਡਬਲ ਜੇ ਲੈਣੀਆਂ ਤਾਂ ਡਬਲ 'ਚ ਤਾਂ ਜ਼ਿਆਦਾ ਵੀ ਪਈਆਂ ਹਨ ਸਿੰਗਲ 'ਚ ਹੈਗੀਆਂ ਤਿੰਨ ਚਾਰ ਹੈਗੀਆਂ ਹਨ ਦੋ ਬੈਡਰੂਮ ਵਾਲੀ ਕੋਠੀ ਹੈਗੀ ਹੈ ਅਤੇ ਵਧੀਆ ਪਾਰਕਿੰਗ ਲਈ ਵੀ ਗੱਡੀ ਖੜ੍ਹਦੀ ਹੈਗੀ ਡੇਢ ਕੁ ਸੌ ਗਜ ਕੋਠੀ ਹੈਗੀ ਹੈ ਉਹ ਤੁਹਾਨੂੰ ਭਾਅ 'ਚ ਮਿਲ ਜਾਊ ਕਿੰਨਾ ਕੁ ਬਜਟ ਤੁਸੀਂ ਕਰਨਾ ਇਨਵੈਸਟ ਅੱਛਾ ਉਹ ਵੀਹ ਕੁ ਲੱਖ ਮੰਗਦੇ ਹੈਗੇ ਅਤੇ ਆਪਾਂ ਕਰ ਲਵਾਂਗੇ ਕੋਈ ਨਹੀਂ ਉਨ੍ਹਾਂ ਨਾਲ ਦੁਬਾਰਾ ਮੈਂ ਗੱਲ ਕਰ ਲਵਾਂਗਾ ਇੱਕ ਹੀ ਵਾਰੀ ਹਾਂ ਬਾਕੀ ਤੁਸੀਂ ਹੋਰ ਦੱਸ ਦਿਓ ਜੇ ਕੋਈ ਮਾੜਾ ਮੋਟਾ ਹੋਰ ਬਜਟ ਇਸ ਤੋਂ ਪੱਚੀ ਕੁ ਤੱਕ ਕਰਨਾ ਹੋਇਆ ਤਾਂ ਇਸ ਤੋਂ ਵਧੀਆ ਹੋਰ ਵੀ ਕੋਠੀਆਂ ਕਾਫੀ ਵਧੀਆ ਪਈਆਂ ਅਤੇ ਰੰਗ ਵਗੈਰਾ ਹੋਇਆ ਪਿਆ ਚੰਗਾ ਹਾਂ ਮੈਂ ਤੁਹਾਨੂੰ ਵਟਸਐਪ ਕਰ ਦੇਵਾਂਗਾ ਬਾਕੀ ਕੋਈ ਨਹੀਂ ਆਪਾਂ ਵਧਾ ਘਟਾ ਲਵਾਂਗੇ ਹੋ ਸਕਦਾ ਇਹ ਅਠਾਰਾਂ ਉੱਨੀ ਕੁ ਤੱਕ ਹੋਜੇ ਹਾਂ ਠੀਕ ਹੈ ਠੀਕ ਹੈ ਓਕੇ ਸਤਿ ਸ਼੍ਰੀ ਅਕਾਲ ਠੀਕ